ਮੈਨੂੰ ਬਾਗਬਾਨੀ ਸ਼ੁਰੂ ਕਰਨ ਦਾ

ਤਰੀਕਾ ਮੇਰੇ ਵੱਡ ਵਡੇਰਿਆਂ ਤੋਂ ਪ੍ਰਾਪਤ ਹੋਇਆ ਜੋ ਕਿ ਆਪਦੇ ਸਮੇਂ ਦੇ ਵਿੱਚ ਬਾਹਰੋਂ ਫੁੱਲਦਾਰ ਬੂਟੇ ਲਿਆ ਕੇ ਘਰ ਬਾਗਵਾਨੀ ਦੇ ਵਿੱਚ ਲਾਉਂਦੇ ਸੀ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀ ਉਹਨਾਂ ਤੋਂ ਮੈਂ ਪ੍ਰੇਰਿਤ ਹੋ ਕੇ ਮੈਂ ਆਪ ਖੁਦ ਅਤੇ ਮੇਰੇ ਘਰ ਵਾਲੀ ਬੱਚੇ ਇਸ ਬਾਗਬਾਨੀ ਦੇ ਵਿੱਚ ਆਪਦੀ ਰੁਚੀ ਦਿਖਾਉਣ ਲੱਗੇ ਅਤੇ ਨਾਨਾ ਨੇ ਬੂਟੇ ਫੁੱਲਾਂ ਵਾਲੇ ਲਿਆ ਕੇ ਘਰ ਲਾਉਣ ਲੱਗੇ ਅਤੇ ਉਹਨਾਂ ਦੀ ਦੇਖ ਰੇਖ ਕਰਕੇ ਸਾਨੂੰ ਬਹੁਤ ਹੀ ਸੁਕੂਨ ਮਿਲਦਾ ਇਹ ਮਨ ਨੂੰ ਬਹੁਤ ਹੀ ਆਨੰਦ ਅਤੇ ਖੇੜਾ ਆਉਂਦਾ ਸੋ ਇਹ ਅਜਿਹੇ ਜਿਹੜੇ ਕਾਰਜ ਨੇ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨੇ ਚਾਹੀਦੇ ਹਨ ਧੰਨਵਾਦ